ਸਾਡੇ ਖੇਤਰ ਵਿੱਚ ਉਭਰਨ ਵਾਲੇ ਮੁੱਖ ਕਲਾ ਰੂਪ ਜਿਵੇਂ ਟੋਕਰੀਆਂ ਬਣਾਉਣਾ ਲੁਹਾਰਾਂ ਵੱਲੋਂ ਲੋਹੇ ਦੇ ਭਾਂਡੇ ਜਿਵੇਂ ਕੜਛਾ ਚਿਮਟਾ ਆਦਿ ਬਣਾਉਣਾ ਅਤੇ ਹੋਰ ਵੀ ਕਿਤੇ ਜੋ ਪਰੰਪਰਾਗਤ ਰੂਪ ਵਿੱਚ ਚੱਲ ਰਹੇ ਸੀ ਅਤੇ ਉਸ ਸਮੇਂ ਦੀਆਂ ਲੋੜਾਂ ਅਨੁਸਾਰ ਉਹਨਾਂ ਕਿੱਤਿਆਂ ਨੂੰ ਵਰਤੋਂ ਕੀਤੀ ਜਾਂਦੀ ਰਹੀ ਹੈ ਵਰਤਮਾਨ ਵਿੱਚ ਉਹਨਾਂ ਕਿੱਤਿਆਂ ਵਿੱਚੋਂ ਹਾਲੇ ਵੀ ਕੁਝ ਟੋਕਰੇ ਬਣਾਉਣਾ ਮਿੱਟੀ ਦੇ ਭਾਂਡਿਆਂ ਵਿੱਚੋਂ ਤੋੜੇ ਬਣਾਉਣਾ ਆਦਿ ਪਰਚਲਿਤ ਹੈ ਜਿਸ ਤਰ੍ਹਾਂ ਵਰਤਮਾਨ ਵਿੱਚ ਵਰਤਮਾਨ ਵਿੱਚ ਭਾਂਡੇ ਬਣਾਉਣ ਵਿੱਚ ਤੌੜੇ ਲਈ ਮਿੱਟੀ ਜੋ ਚਾਹੀਦੀ ਹੈ ਜਾਂ ਹੋਰ ਭਾਂਡਿਆਂ ਲਈ ਮਿੱਟੀ ਚਾਹੀਦੀ ਹੈ ਉਹ ਆਮ ਲੋਕਲ ਖ਼ੇਤਰ ਵਿੱਚੋਂ ਮਿਲ ਜਾਂਦੀ ਹੈ ਇਸ ਤਰ੍ਹਾਂ ਹੋਰ ਕਿੱਤੇ ਜਿਵੇਂ ਤਰਖਾਣਾ ਵੱਲੋਂ ਮੰਜੇ ਠੋਕਣਾ ਜਾਂ ਹੋਰ ਕੰਮ ਜਿਹੜਾ ਖੇਤੀ ਦੇ ਪੰਜਾਬ ਦੇ ਖੇਤੀ ਸਬੰਧੀ ਸੰਦ ਜਾਂ ਹੋਰ ਲੋੜਵੰ ਲੋੜਵੰਦ ਸੰਦਾਂ ਨੂੰ ਬਣਾਉਣਾ ਅਤੇ ਉਹਨਾਂ ਨੂੰ ਤਿਆਰ ਕਰਨਾ ਆਦਿ ਦੀ ਜ਼ਰੂਰਤ ਹੈ ਪਸ਼ੂਆਂ ਦੇ ਖੁਰ ਘੜਨਾ ਅਤੇ ਹੋਰ ਪਸ਼ੂਆਂ ਦੇ ਸਿੰਗ ਸਹੀ ਸਿੰਗ ਸਹੀ ਕਰਨਾ ਆਦਿ ਇਸ ਕਿੱਤੇ ਵਿੱਚ ਆਉਂਦੇ ਹਨ ਜਿਸ ਤਰ੍ਹਾਂ ਵਰਤਮਾਨ ਵਿੱਚ ਟੋਕਰਿਆਂ ਦੀ ਜਗ੍ਹਾ ਪਲਾਸਟਿਕ ਦੀਆਂ ਟੋਕਰੀਆਂ ਅਤੇ ਹੋਰ ਭਾਂਡੇ ਪਲਾਸਟਿਕ ਦੇ ਭਾਂਡੇ ਆਉਣ ਲੱਗ ਗਏ ਤੌੜਿਆਂ ਦੀ ਥਾਂ 'ਤੇ ਕੈਂਪਰ ਵਾਟਰ ਕੂਲਰ ਜਾਂ ਰੈਫਰੀਜਨਰੇਟਰ ਆਦਿ ਆਉਣ ਲੱਗ ਗਏ ਇਹਨਾਂ ਨੇ ਸਮਕਾਲੀ ਸਮੇਂ ਵਿੱਚ ਉਹਨਾਂ ਚੀਜ਼ਾਂ ਨੂੰ ਪਿਛੋੜ ਕੇ ਆਪਣੀ ਥਾਂ ਬਣਾ ਲਈ